ਪੰਜਾਬ ਦਾ ਪ੍ਰਸਿੱਧ ਭੋਜਨ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇਸ ਵਿੱਚ ਮਸਾਲੇ ਪਾ ਕੇ ਹੋਰ ਵੀ ਸ਼ਾਨਦਾਰ ਬਣਾ ਦਿੰਦੇ ਹਨ ਜੋ ਕਿ ਲੋਕ ਦੂਰੋਂ ਦੂਰੋਂ ਖਾਣ ਲਈ ਪੰਜਾਬ ਵਿੱਚ ਆਉਂਦੇ ਹਨ ਪੰਜਾਬ ਦੇ ਹਰ ਇੱਕ ਰਸੋਈ ਅਤੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਮੁੱਖ ਪਕਵਾਨ ਹੈ ਪੰਜਾਬ ਦੇ ਲੋਕ ਇੱਕ ਖਾ ਕੇ ਬਹੁਤ ਖੁਸ਼ ਹੁੰਦੇ ਹਨ ਕਈ ਲੋਕ ਇਸ ਨੂੰ ਵਾਰ ਵਾਰ ਖਾਣ ਆਉਂਦੇ ਹਨ ਅਤੇ ਬਹੁਤ ਹੀ ਮਨ ਖੁਸ਼ ਹੁੰਦਾ ਹੈ ਪੰਜਾਬ ਦੇ ਲੋਕ ਖਾਣਾ ਖਾਣ ਵਿੱਚ ਪਹਿਲਾਂ ਹੁੰਦੇ ਹਨ ਪੰਜਾਬ ਦੀ ਹਰ ਇੱਕ ਜਗ੍ਹਾ 'ਤੇ ਦੂਜੀ ਜਗ੍ਹਾ ਤੋਂ ਖਾਣਾ ਖਾਣ ਲਈ ਜਾਂਦੇ ਹਨ ਇਹ ਹਰ ਹਰ ਇੱਕ ਜਗ੍ਹਾ 'ਤੇ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਬਹੁਤ ਹੀ ਪ੍ਰਸਿੱਧ ਹੈ ਇਸ ਲਈ ਇਸ ਲਈ ਇਸ ਦੁਨੀਆਂ